ਹੈਲੋ ਨਮਸਤੇ ਮੈਮ ਨਮਸਤੇ ਜੀ ਮੈਮ ਮੇਰੀ ਨਾ ਬੇਟੀ ਪੜ੍ਹਦੀ ਆ ਜੀ ਆਪਣੇ ਸਕੂਲ 'ਚ ਮੈਂ ਇਹ ਪੁੱਛਦੀ ਜੀ ਉਹਨਾਂ ਨੂੰ ਮੈਂ ਮਤਲਬ ਕਿਹੜੇ ਕਿਹੜੇ ਈਵੈਂਟ 'ਚ ਲਵਾ ਸਕਦੀ ਹੈਗੀ ਵੀ ਉਹ ਕਿਹੜੇ ਕਿਹੜੇ ਈਵੈਂਟ ਕਰ ਸਕਦੀ ਆ ਆਪਣੇ ਸਕੂਲ 'ਚ ਈਵੈਂਟ ਤਾਂ ਹੈਗੇ ਆ ਨਾ ਕਾਫੀ ਖੇਡਾ ਖੁੱਡਾਂ 'ਚ ਪੜ੍ਹਾਈ ਵਿੱਚ ਵੀ ਹੈਗੇ ਹੈਗੇ ਮੈਮ ਤੁਹਾਡੇ ਹਿਸਾਬ ਨਾਲ ਮੈਂ ਮਤਲਬ ਕਿਹੜੇ ਉਹਦੇ 'ਚ ਲਗਾ ਸਕਦੀ ਹਾਂ ਆਪਣੀ ਬੇਟੀ ਨੂੰ ਹਾਂਜੀ ਹਾਂਜੀ ਹਾਂਜੀ ਮੈਮ ਗੋਲੇ 'ਚ ਉਹ ਅੰਡਰ ਫੋਟੀਨ 'ਚ ਆ ਜੀ ਲੱਗ ਸਕਦੀ ਆ ਨਾ ਉਹ ਸੁੱਟ ਲੈਂਦੀ ਆ ਗੋਲਾ ਮੈਮ ਪਹਿਲਾਂ ਜਿਹੜੇ ਸਕੂਲ ਵੀ ਲੱਗੀ ਹੋਈ ਸੀਗੀ ਉਹ 'ਚ ਸੁੱਟ ਲੈਂਦੀ ਸੀਗੀ ਅਤੇ ਫਿਰ ਬਾਅਦ 'ਚੋਂ ਅਸੀਂ ਉੱਥੋਂ ਹਟਾਈ ਲਈ ਫਿਰ ਤਾਂ ਇੱਥੇ ਲਾਤੀ ਸੀ ਅਤੇ ਉਹ ਲਹਿਰੀ ਮਤਲਬ ਰੇਸਾਂ ਵਿੱਚ ਵੀ ਉਹ ਭਾਗ ਲੈ ਲੈਂਦੀ ਹੈਗੀ ਅਤੇ ਲੌਂਗ ਜੰਪ 'ਚ ਵੀ ਲੈ ਲੈਂਦੀ ਹੈਗੀ ਅੱਛਾ ਫਿਰ ਮੈਮ ਉਹਦੀ ਪ੍ਰੈਕਟਿਸ ਲਈ ਹਾਂਜੀ ਓਕੇ ਮੈਮ ਫਿਰ ਇਹਦੀ ਕੋਈ ਅਲੱਗ ਤੋਂ ਮਤਲਬ ਫੀਸ ਫੂਸ ਤਾਂ ਨਹੀਂ ਹੈਗੀ ਅੱਛਾ ਫਿਰ ਮੈਮ ਕੁਛ ਹੋਰ ਮਤਲਬ ਕੋਈ ਹੋਰ ਮਤਲਬ ਖੇਡਾਂ ਨੂੰ ਛੱਡ ਕੇ ਵੀ ਹੋਰ ਵੀ ਪੜ੍ਹਾਈ 'ਚ ਵੀ ਐਕਟੀਵਿਟੀ ਹੁੰਦੀਆਂ ਨੇ ਅਤੇ ਉਹ ਵੀ ਹੋਣਗੀਆਂ ਨਾ ਹਾਂਜੀ ਵਧੀਆ ਪੜ੍ਹਦੀ ਹੈ ਜੀ ਖੇਡਦੀ ਵਧੀਆ ਹੈਗੀ ਜੀ ਲੱਗੀ ਹੋਈ ਸੀਗੀ ਉਹ ਰੇਸਾਂ 'ਚ ਕਹਿੰਦੀ ਸੀਗੀ ਮਤਲਬ ਮੈਂ ਲਗਾਈ ਲਗਾਇਆ ਜੀ ਮੈਨੂੰ ਰੇਸਾਂ 'ਚ ਮੈਡਮ ਨੇ ਵਧੀਆ ਭੱਜ ਲੈਂਦੀ ਆ ਜੀ ਮੈਮ ਇੱਕ ਉੱਧਰ ਨੂੰ ਸ਼ੌਕ ਆ ਜੀ ਫੁਟਬਾਲ ਖੇਡਣ ਦਾ ਉਹ ਕਹਿੰਦੀ ਸੀਗੀ ਕਿ ਸਕੂਲ 'ਚ ਟੀਮ ਬਣੀ ਹੋਈ ਹੈਗੀ ਵੀ ਮੈਡਮ ਨਾਲ ਗੱਲ ਕਰ ਲਿਓ ਵੀ ਉਹਨੂੰ ਲਗਾ ਲੈਣ ਨਾਲ ਮੈਮ ਦੇਖ ਲਿਓ ਫਿਰ ਅਗਰ ਠੀਕ ਹੈ ਹਾਂਜੀ ਥੈਂਕ ਯੂ ਮੈਮ ਠੀਕ ਹੈ ਜੀ